ਹਾਂਜੀ ਅਸੀਂ ਪੰਜਾਬੀ ਦੀ ਖੇਤਰੀ ਭਾਸ਼ਾ ਸਿੱਖੀ ਹੈ ਜਿਵੇਂ ਕਿ ਮਲਵਈ ਉਪ ਬੋਲੀ ਸਤਲੁਜ ਦੇ ਪਾਰਲੇ ਇਲਾਕੇ ਜਿਵੇਂ ਕਿ ਫਿਰੋਜ਼ਪੁਰ ਲੁਧਿਆਣਾ ਪਟਿਆਲਾ ਫਰੀਦਕੋਟ ਬਠਿੰਡਾ ਮਾਨਸਾ ਮੋਗਾ ਸੰਗਰੂਰ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਇੱਥੇ ਵਾਵੇ ਦੀ ਥਾਂ ਮਮਾ ਵਰਤਿਆ ਜਾਂਦਾ ਹੈ ਜਿਵੇਂ ਤੀਵੀਂ ਨੂੰ ਤੀਮੀ ਅਤੇ ਜਾਵਾਂਗਾ ਨੂੰ ਜਾਮਾਂਗਾ ਆਦਿ ਬੋਲਿਆ ਜਾਂਦਾ ਹੈ ਦਰਿਆਵਾਂ ਪਹਾੜਾਂ ਅਤੇ ਬਿਖੜੇ ਰਾਹਾਂ ਦੇ ਪਾਰ ਲੋਕਾਂ ਦੀ ਬੋਲੀ ਵਿੱਚ ਉਚਾਰਨ ਅਤੇ ਸ਼ਬਦਾਵਲੀ ਪੱਖੋਂ ਛੋਟਾ ਮੋਟਾ ਅੰਤਰ ਆ ਜਾਂਦਾ ਹੈ ਇਸ ਤਰ੍ਹਾਂ ਦੀ ਅੰਤਰਾਂ ਕਾਰਨ ਇੱਕੋ ਭਾਸ਼ਾ ਦੇ ਜੋ ਵੱਖ ਵੱਖ ਰੂਪ ਪ੍ਰਤੀਤ ਹੁੰਦੇ ਹਨ ਉਹਨਾਂ ਨੂੰ ਉਪਭਾਸ਼ਾ ਜਾਂ ਉਪ ਭਾਸ਼ਾਈ ਰੂਪ ਕਿਹਾ ਜਾਂਦਾ ਹੈ ਪੰਜਾਬੀ ਦੀਆਂ ਉਪ ਬੋਲੀਆਂ ਉਪ ਭਾਸ਼ਾਵਾਂ ਇਹ ਹਨ ਮਾਝੀ ਦੁਆਬੀ ਮਲਵਈ ਪੋਆਧੀ ਪੋਠੋਹਾਰੀ ਮੁਲਤਾਨੀ ਹਿੰਦੀ ਅਤੇ ਡੋਗਰੀ ਹਨ ਉਪ ਬੋਲੀ ਬੋਲ ਚਾਲ ਦੀ ਬੋਲੀ ਦੇ ਵੱਖ ਵੱਖ ਰੂਪ ਹੁੰਦੇ ਹਨ ਇੱਕ ਇਲਾਕੇ ਵਿੱਚ ਕੁਝ ਖਾਸ ਸ਼ਬਦ ਵਰਤੇ ਜਾਂਦੇ ਹਨ ਅਤੇ ਦੂਜੇ ਵਿੱਚ ਕੁਝ ਹੋਰ ਬੋਲ ਚਾਲ ਦੀ ਬੋਲੀ ਦੇ ਇਹਨਾਂ ਵੱਖੋ ਵੱਖਰੇ ਰੂਪ ਨੂੰ ਉਪ ਬੋਲੀ ਜਾਂ ਉਪ ਭਾਸ਼ਾਵਾਂ ਵੀ ਕਿਹਾ ਜਾਂਦਾ ਹੈ